ਹਾਂਜੀ ਸਤਿ ਸ਼੍ਰੀ ਅਕਾਲ ਜੀ ਡਰਾਈਵਰ ਸਾਹਿਬ ਬੋਲਦੇ ਹਾਂਜੀ ਅਸੀਂ ਦਰਬਾਰ ਸਾਹਿਬ ਦਾ ਅ ਪਲੈਨ ਬਣਾ ਰਹੇ ਹਾਂ ਹਾਂਜੀ ਸਾਡਾ ਘਰ ਕਾਲਜ ਦੇ ਕੋਲ ਆ ਰੋਪੜ ਕਾਲਜ ਦੇ ਕੋਲ ਹਾਂਜੀ ਸ਼ਾਮ ਨੂੰ ਅਸੀਂ ਸੱਤ ਵਜੇ ਠੀਕ ਹੈ ਤੁਸੀਂ ਫਿਰ ਸੱਤ ਵਜੇ ਸਾਨੂੰ ਕਾਲਜ ਦੇ ਮੁਹਰੋਂ ਲੈ ਲਓ ਅਤੇ ਸਾਨੂੰ ਅੰਮ੍ਰਿਤਸਰ ਘੁਮਾ ਲਿਆਓ ਅਤੇ ਹਾਂ ਅਸੀਂ ਛੇ ਜਣੇ ਹਨ ਜੀ ਛੇ ਜਣੇ ਹਨ ਹਾਂਜੀ ਠੀਕ ਹੈ ਜੀ ਕਿੰਨੇ ਪੈਸੇ ਜੀ ਤਿੰਨ ਹਜ਼ਾਰ ਰੁਪਈਆ ਠੀਕ ਹੈ ਜੀ